ਸ਼ਹੀਦ ਭਗਤ ਦ ਸਿੰਘ ਨਗਰ ਦਾ ਰਹਿਣ ਵਾਲਾ ਹਾਂ ਪਿੰਡ ਇਹ ਬਲਾ ਸ਼ਹਿਰ ਬਲਾਚੋਰ ਵਿੱਚ ਸਬਜ਼ੀ ਮੰਡੀ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਲੱਗਦੀਆਂ ਹਨ ਇਸ ਸ਼ਹਿਰ ਵਿੱਚ ਸਟੀਲ ਦੇ ਭਾਂਡੇ ਆਦਿ ਬਹੁਤ ਕੁਛ ਮਿਲ ਜਾਂਦਾ ਹੈ ਅਤੇ ਬਹੁਤ ਦੂਰੋਂ ਦੂਰੋਂ ਹੀ ਲੋਕ ਇਸ ਸ਼ਹਿਰ ਵਿੱਚ ਸਬਜ਼ੀਆਂ ਆਦਿ ਖਰੀਦਣ ਆਉਂਦੇ ਸਨ ਅਤੇ ਇਸ ਸ਼ਹਿ ਇਹ ਮੇਲਾ ਹਰਾ ਭਰਾ ਰਹਿੰਦਾ ਹੈ ਅਤੇ ਇਸ ਇਸ ਸ਼ਹਿਰ ਵਿੱਚ ਬਹੁਤ ਬਹੁਤ ਹੋਰ ਹੋਰ ਸ਼ਹਿਰਾਂ ਨਾਲੋਂ ਘੱਟ ਰੇਟ ਵਿੱਚ ਚੀਜ਼ਾਂ ਮਿਲਦੀਆਂ ਹਨ ਅਤੇ ਇਸ ਕਰਕੇ ਲੋਕ ਇਸ ਸ਼ਹਿਰ ਵਿੱਚ ਬਹੁਤ ਜ਼ਿਆਦਾ ਆਉਂਦੇ ਸਨ ਇਸ ਲਈ ਜਿਸ ਏ ਜਿਹੜੇ ਪਿੰਡਾਂ ਵਾਲੇ ਲੋਕ ਹਨ ਉਹ ਤਾਂ ਰੋਜ਼ ਹੀ ਏ ਰ ਆਏ ਐਤਵਾਰ ਨੂੰ ਸਬਜ਼ੀ ਆਦਿ ਖਰੀਦਣ ਆਉਂਦੇ ਹਨ